ਕੱਲ ਰਾਤੀ ਜਦੋਂ ਮੈਂ ਖਾਣਾ ਬਣਾ ਰਹੀ ਸੀ ਤਾਂ ਮੈਂ ਖਾਣਾ ਖਾਣ ਤੋਂ ਬਾਅਦ ਜੂਠੇ ਬਰਤਨ ਮਾਂਜਣ ਲਈ ਪਾਣੀ ਦੇ ਨਲ ਨੂੰ ਛੱਡਿਆ ਤਾਂ ਮੈਂ ਦੇਖਿਆ ਉਸ ਵਿੱਚੋਂ ਪਾਣੀ ਆਉਣਾ ਬੰਦ ਹੋ ਗਿਆ ਪਹਿਲਾਂ ਜਦ ਮੈਂ ਕੰਮ ਕਰ ਰਹੀ ਸੀ ਉਸ ਸਮੇਂ ਪਾਣੀ ਆ ਰਿਹਾ ਸੀ ਮੈਂ ਇੱਕ ਵਾਰ ਫਿਰ ਨਲ ਬੰਦ ਕਰਕੇ ਚਲਾਇਆ ਤਾਂ ਵੀ ਪਾਣੀ ਨਾ ਆਇਆ ਫਿਰ ਮੈਂ ਉੱਪਰ ਜਾ ਕੇ ਪਾਣੀ ਵਾਲੀ ਟੈਂਕੀ ਚੈੱਕ ਕੀਤੀ ਤਾਂ ਉਸ ਵਿੱਚ ਪਾਣੀ ਨਹੀਂ ਸੀ ਤਾਂ ਮੈਂ ਮੰਨ ਲਿਆ ਕਿ ਪਾਣੀ ਦੀ ਸਮੱਸਿਆ ਹੋ ਗਈ ਹੈ ਅੱਗੋਂ ਹੀ ਪਾਣੀ ਦੀ ਸਪਲਾਈ ਬੰਦ ਹੋ ਗਈ ਸੀ ਮੈਨੂੰ ਪਤਾ ਲੱਗਿਆ ਕਿ ਪਾਣੀ ਦੀ ਸਪਲਾਈ ਵਿੱਚ ਦਿੱਕਤ ਹੈ ਮੈਂ ਘਰ ਵਿੱਚੋਂ ਜਲ ਦੀ ਅਥਾਰਟੀ ਦੀ ਸ਼ਿਕਾਇਤ ਕਰਨ ਲਈ ਜਲਦੀ ਰਸੀਦ ਚੁੱਕੀ ਤੇ ਜਲ ਅਥਾਰਟੀ ਵਾਲਿਆਂ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਲਈ ਦਿੱਤੇ ਗਏ ਨੰਬਰ ਤੇ ਸੰਪਰਕ ਕਰਾਂਗੀ ਤਾਂ ਕਿ ਉਹ ਮੇਰੀ ਸਹਾਇਤਾ ਕਰ ਸਕਣ ਕਿਰਪਾ ਕਰਕੇ ਮੈਨੂੰ ਜਲ ਮੁਹਈਆ ਕਰਵਾਇਆ ਜਾਵੇ ਤਾਂ ਕਿ ਮੈਂ ਆਪਣੇ ਘਰ ਦੇ ਸਾਰੇ ਕੰਮ ਨੇਪਰੇ ਚਾੜ ਸਕਾਂ ਮੈਨੂੰ ਪਾਣੀ ਦੀ ਸਮੱਸਿਆ ਬਹੁਤ ਵੱਡੀ ਲੱਗ ਰਹੀ ਹੈ ਕਿਉਂਕਿ ਸਾਰੇ ਕੰਮ ਪਾਣੀ ਨਾਲ ਹੀ ਹੁੰਦੇ ਹਨ ਕਿਰਪਾ ਕਰਕੇ ਮੇਰੀ ਇਹ ਬੇਨਤੀ ਹੈ ਕਿ ਪਾਣੀ ਦੀ ਸਪਲਾਈ ਸਾਡੀ ਮੁੜ ਤੋਂ ਬਹਾਲ ਕੀਤੀ ਜਾਵੇ ਕਿਰਪਾ ਕਰਕੇ ਇਸ ਚੀਜ਼ ਵੱਲ ਵਿਸ਼ੇਸ਼ ਤੌਰ 'ਤੇ ਤੁਸੀਂ ਧਿਆਨ ਦੇਵੋ ਜੀ ਧੰਨਵਾਦ